ਹੈਲੋ ਭਾਅ ਜੀ ਤੁਸੀਂ ਸਵੈਗੀ ਤੋਂ ਬੋਲ ਰਹੇ ਜੇ ਅਸੀਂ ਨਾ ਤੁਹਾਡੇ ਰੈਸਟੋਰੈਂਟ ਤੋਂ ਪੀਜ਼ਾ ਔਡਰ ਕੀਤਾ ਸੀਗਾ ਅਤੇ ਜਦੋਂ ਡਿਲੀਵਰੀ ਬੋਆਏ ਉਹ ਪੀਜ਼ਾ ਲੈ ਕੇ ਆਏ ਤਾਂ ਅਸੀਂ ਆਪਣੇ ਬੱਚਿਆਂ ਵਿੱਚ ਵੰਡ ਕੇ ਸਭ ਨੇ ਖਾਦਾ ਜਦੋਂ ਮੈਂ ਟੇਸਟ ਕੀਤਾ ਤਾਂ ਮੈਨੂੰ ਉਹ ਨਾ ਬੜਾ ਅਜੀਬ ਜਿਹਾ ਲੱਗਾ ਕਿਉਂਕਿ ਉਹਦਾ ਟੇਸਟ ਬਹੁਤ ਖਰਾਬ ਸੀਗਾ ਪੀਜ਼ਾ ਬਿਲਕੁਲ ਖਰਾਬ ਸੀਗਾ ਉਹਦੇ ਵਿੱਚ ਬਾਸੀ ਵੈਜੀਟੇਬਲਸ ਹੈ ਨਾ ਇੱਦਾਂ ਪਾਏ ਸੀਗੇ ਅਤੇ ਪੀਜ਼ਾ ਥੋੜ੍ਹਾ ਬਹੁਤ ਜ਼ਿਆਦਾ ਟੇਸਟ ਖਰਾਬ ਸੀਗਾ ਅਤੇ ਉਹਦੇ ਨਾਲ ਸਾਡੇ ਬੱਚਿਆਂ ਦੀ ਸਿਹਤ ਵੀ ਵਿਗੜ ਸਕਦੀ ਹੈ ਤੁਸੀਂ ਕਿਸੇ ਹੋਰ ਨੂੰ ਭੇਜੋਗੇ ਤਾਂ ਉਹਨਾਂ ਦੀ ਸਿਹਤ ਵੀ ਵਿਗੜ ਸਕਦੀ ਹੈ ਇਸ ਕਰਕੇ ਤੁਹਾਨੂੰ ਰਿਕੁਐਸਟ ਆ ਕਿ ਕਿਸੇ ਹੋਰ ਦੀ ਸਿਹਤ ਨਾ ਖਰਾਬ ਹੋਵੇ ਤੁਸੀਂ ਪੀਜ਼ਾ ਸਹੀ ਤਰੀਕੇ ਨਾਲ ਸਹੀ ਤਰ੍ਹਾਂ ਬਣਾ ਕੇ ਉਹਦਾ ਟੇਸਟ ਦੇਖ ਕੇ ਅੱਗੇ ਤੁਸੀਂ ਭੇਜਣਾ ਠੀਕ ਹੈ ਨਾ ਕਿਉਂਕਿ ਇੱਦਾਂ ਸਾਰੇ ਬੱਚਿਆਂ ਦੀ ਸਿਹਤ ਖਰਾਬ ਹੋ ਸਕਦੀ ਹੈ ਔਡਰ ਕੀਤਿਆਂ